ਸੋਸ਼ਲ ਮੀਡੀਆ ਦੇ ਵਿੱਚ ਆਪਣੀ ਤਸਵੀਰਾਂ ਪਾਉਂਦੇ ਹਨ ਜਿਵੇਂ ਫੇਸਬੁੱਕ ਇੰਸਟਾਗ੍ਰਾਮ ਵਿੱਚ ਤਸਵੀਰ ਆ ਜਾਂਦੀ ਹੈ ਇਹ ਤਸਵੀਰਾਂ ਮੇਰੀ ਯਾਦਗਾਰ ਹਨ ਉੱਥੇ ਤਸਵੀਰਾਂ ਵਿੱਚ ਮੇਰੀ ਸਹੇਲੀ ਦੀ ਫੋਟੋ ਯਾਦਗਾਰਾਂ ਹਨ ਅਤੇ ਇਹ ਫੋਟੋ ਡਿਲੀਟ ਹੋ ਜਾਂਦੀ ਹੈ ਤਾਂ ਅਸੀਂ ਫੋਟੋ ਉਸ ਵਿੱਚ ਐਡ ਕਰ ਸਕਦੇ ਹਾਂ ਉਹ ਫੋਟੋ ਸਾਡੀ ਜ਼ਿੰਦਗੀ ਦੀਆਂ ਯਾਦਾਂ ਨੂੰ ਜ਼ਿੰਦਗੀ ਦੀ ਯਾਦਾਂ ਨੂੰ ਯਾਦ ਦਿਲਾਉਂਦੀ ਹੈ ਬਚਪਨ ਦੀਆਂ ਵੀ ਫੋਟੋਆਂ ਸਾਡੇ ਕੋਲ ਬਹੁਤ ਸਨ ਇੰਸਟਾ 'ਤੇ ਮੇਰੀਆਂ ਬਹੁਤ ਹੀ ਬਚਪਨ ਦੀਆਂ ਫੋਟੋਆਂ ਸਨ ਅਤੇ ਪਹਿਲੇ 'ਤੇ ਮੇਰੇ ਸਕੂਲ ਜਾਂਦੀਆਂ ਫਰੈਂਡਾ ਦੀਆਂ ਯਾਦਗਾਰ ਫੋਟੋਆਂ ਸਨ ਇਹ ਫੋਟੋਆਂ ਸਾਡੇ ਵਿਆਹ ਵਿੱਚ ਮਹੱਤਵਪੂਰਨ ਹਨ